ਭੰਗੜੇ ਬਾਰੇ ਕਈ ਗਲਤ ਧਾਰਨਾਵਾਂ ਹੈ ਜੀ ਜੋ ਲੋਕ ਆਮ ਤੌਰ ਤੇ ਮੰਨਦੇ ਹਨ ਸਭ ਤੋਂ ਵੱਡੀ ਗਲਤੀਫਹਿਮੀ ਹੈ ਕਿ ਭੰਗੜਾ ਮੌਜ਼ ਮਸਤੀ ਅਤੇ ਸ਼ਰਾਬ ਸਰੁੂਬੀ ਨਾਲ ਜੁੜਿਆ ਹੋਇਆ ਨਾਚ ਹੈ ਹਾਲਾਂਕਿ ਇਸ ਵਿੱਚ ਪੰਜਾਬ ਦੀ ਸੰਸਕ੍ਰਿਤੀ ਵਿਰਾਸਤ ਇੱਕ ਮਹੱਤਵਪੂਰਨ ਹਿੱਸਾ ਹੈ ਕੁਝ ਲੋਕ ਸੋਚਦੇ ਹਨ ਕਿ ਭੰਗੜਾ ਸਿਰਫ ਪੁਰਸ਼ ਹੀ ਕਰ ਸਕਦੇ ਹਨ ਪਰ ਇਹ ਵੀ ਬਹੁਤ ਗਲਤ ਹੈ ਕਿਉਂਕਿ ਅੱਜਕੱਲ ਦੀਆਂ ਕੁੜੀਆਂ ਭੰਗੜੇ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੀਆਂ ਹਨ ਹੋਰ ਗਲਤ ਧਾਰਨਾ ਇਹ ਵੀ ਹੈ ਕਿ ਭੰਗੜਾ ਸਿਰਫ ਪਿੰਡਾਂ ਵਿੱਚ ਹੀ ਕੀਤਾ ਜਾਂਦਾ ਹੈ ਜਦ ਕਿ ਹੁਣ ਇਹ ਵਿਸ਼ਵ ਪੱਧਰ ਤੇ ਪ੍ਰਸਿੱਧ ਹੋ ਗਿਆ ਹੈ ਅਤੇ ਕਈ ਦੇਸ਼ਾਂ ਵਿੱਚ ਭੰਗੜੇ ਦੀਆਂ ਮਸ਼ਹੂਰ ਟੀਮਾਂ ਬਣ ਚੁੱਕੀਆਂ ਹਨ ਬਹੁਤ ਸਾਰੇ ਲੋਕ ਇਹ ਵੀ ਮੰਨਦੇ ਆ ਕੀ ਭੰਗੜਾ ਸਿਰਫ ਇੱਕ ਮਿਉਚਲ ਨਾਚ ਹੈ ਅਤੇ ਇਸ ਦਾ ਕੋਈ ਢੰਗ ਨਹੀਂ ਹੁੰਦਾ ਪਰ ਭੰਗੜੇ ਦੇ ਵੀ ਖਾਸ ਅੰਦਾਜ਼ ਨਿਯਮ ਹੁੰਦੇ ਆ ਜੋ ਪੂਰੀ ਤਰ੍ਹਾਂ ਤਕਨੀਕੀ ਤਰਤੀਬ ਬੰਦ ਹੁੰਦੇ ਆ ਪਰ ਅਸਲ ਵਿੱਚ ਇੱਕ ਸਰੀਰਕ ਤੌਰ ਤੇ ਮਕਾਉਣ ਥਕਾਉਣ ਵਾਲੀ ਕਲਾ ਹੈ ਜੋ ਬਹੁਤ ਸਾਰੀ ਮਿਹਨਤ ਸਹਿਯੋਗ ਅਤੇ ਸਹੀ ਤਕਨੀਕ ਦੀ ਮੰਗ ਕਰਦੀ ਹੈ ਇਸ ਤਰਾਂ ਭੰਗੜੇ ਬਾਰੇ ਕਈ ਲੋਕਾਂ ਦੀਆਂ ਕਈ ਗਲਤ ਫਹਿਮੀਆਂ ਹਨ

ਇਹ ਪੰਜਾਬੀ ਪਛਾਣ ਖੁਸ਼ੀ ਅਤੇ ਉਤਸਾਹ ਦੀ ਇੱਕ ਮਹੱਤਵਪੂਰਨ ਰੇਖਾ ਹੈ ਭੰਗੜੇ ਦੇ ਵਿੱਚ ਆਪਾਂ ਕਈ ਤਰ੍ਹਾਂ ਦੇ ਸਹਿਯੋਗ ਸਹਿ ਤਕਨੀਕ ਦੀ ਮੰਗ ਕਰਦੇ ਹਾਂ ਇਸ ਤਰਾਂ ਭੰਗੜੇ ਵਾਲੇ ਕਈ ਬੰਦਿਆਂ ਦੀਆਂ ਕਈ ਗਲਤ ਫਹਿਮੀਆਂ ਹੋ ਸਕਦੀਆਂ ਹਨ ਕਈ ਕਹਿੰਦੇ ਆ ਜੀ ਭੰਗੜਾ ਬਹੁਤ ਆਸਾਨ ਹੁੰਦਾ ਹੈ ਪਰ ਅਸਲ ਵਿੱਚ ਇੱਕ ਇਕ ਸਰੀਰਿਕ ਐਕਸਰਸਾਈਜ਼ ਕਰਨ ਵਾਲੀ ਵੀ ਕਲਾ ਹੈ

ਹੁਣ ਤਾਂ ਬਾਹਰਲੇ ਦੇਸ਼ਾਂ ਵਿੱਚ ਵੀ ਕਈ ਭੰਗੜੇ ਦੀਆਂ ਟੀਮਾਂ ਬਣ ਗਈਆਂ ਹਨ ਔਰ ਕਈ ਤਰ੍ਹਾਂ ਦੇ ਉਥੇ ਮੁਕਾਬਲੇ ਹੁੰਦੇ ਹਨ ਬਾਹਰਲੇ ਦੇਸ਼ ਬਾਰੇ ਲੋਕ ਵੀ ਭੰਗੜੇ ਨੂੰ ਕਾਫੀ ਤਵਜੋ ਦਿੰਦੇ ਹਨ ਅਤੇ ਅਤੇ ਉਹ ਭੰਗੜੇ ਨੂੰ ਬਹੁਤ ਹੀ ਪਸੰਦ ਕਰਦੇ ਹਨ